ਦੁੱਧ ਦੇ ਫੈਟ ਨੂੰ ਵਧਾਉਣ ਲਈ ਅਮੀਨੋ ਐਸੀਡ ਦੇ ਸੰਤੁਲਨ ਨੂੰ ਬਣਾਉਣਾ ਚਾਹੀਦਾ ਹੈ ਅਮੀਨੋ ਐਸੀਡ ਦੇ ਸੰਤੁਲਨ ਨਾਲ ਦੁੱਧ ਦੇ ਫੈਂਟ ਨੂੰ ਵਧਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਉਹ ਚਾਰੇ ਦੀ ਗੁਣਵੱਤਾ ਨੂੰ ਵੀ ਠੀਕ ਰੱਖ ਕੇ ਉਸ ਦੇ ਫੈਟ ਨੂੰ ਵਧਾਇਆ ਜਾ ਸਕਦਾ ਹੈ